ਹੈਲੋ ਹੈਲੋ ਹਾਂਜੀ ਕਿੱਥੋਂ ਤੁਸੀਂ ਦੁਖਨਿਵਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਸੀਂ ਦੁਖਨਿਵਾਰਨ ਸਾਹਿਬ ਤੋਂ ਬੋਲਦੇ ਹੋ ਮੈਨੇਜਰ ਸਾਹਿਬ ਹਾਂਜੀ ਮੈਂ ਬਾਹਰੋਂ ਆ ਰਹੀ ਹਾਂ ਅਤੇ ਮੈਂ ਇੱਥੇ ਦੁਖਨਿਵਾਰਨ ਸਾਹਿਬ ਆ ਕੇ ਰੁਕਣਾ ਥੋੜ੍ਹੀ ਥੋੜ੍ਹੀ ਭਾਵਨਾ ਅਤੇ ਲੈ ਕੇ ਆਉਣਾ ਹੈਗਾ ਮੱਥਾ ਟੇਕਣਾ ਹੈ ਅਤੇ ਦਰਸ਼ਨ ਮੇਲੇ ਕਰਨੇ ਨੇ ਅਤੇ ਇਸ ਕਰਕੇ ਦੋ ਦਿਨ ਵਾਸਤੇ ਸਾਨੂੰ ਇੱਥੇ ਕਮਰਾ ਮਿਲ ਜਾਏਗਾ ਇਹ ਪਰਸੋਂ ਆਵਾਂਗੇ ਠੀਕ ਏ ਚਲੋ ਫਿਰ ਦਾ ਫਿਰ ਅਤੇ ਵਧੀਆ ਹੋਰ ਇੱਥੇ ਕੀ ਹੋਰ ਕੀ ਦੇਖਣ ਨੂੰ ਇੱਥੇ ਦੁਖਨਿਵਾਰਨ ਸਾਹਿਬ ਕੋਈ ਹੋਰ ਗੁਰੂਦਵਾਰਾ ਅੱਛਾ ਹੋਰ ਕੋਈ ਇੱਥੇ ਹੋਰ ਪ੍ਰੋਗਰਾਮ ਨਹੀਂ ਹੁੰਦਾ ਕੋਈ ਇੱਥੇ ਪਰਸੋਂ ਪਰਸੋਂ ਅੱਛਾ ਅਤੇ ਕੀਰਤਨ 'ਚ ਸਾਰਾ ਦਿਨ ਕੀਰਤਨ ਸਾਰਾ ਦਿਨ ਚਲਦਾ ਰਹਿੰਦਾ ਠੀਕ ਏ ਅਤੇ ਕਮਰੇ ਇੱਦਾਂ ਫਿਰ ਕੀ ਉਹਦਾ ਹਿਸਾਬ ਕਿਤਾਬ ਕਿਵੇਂ ਏਸੀ ਵਾਲੇ ਰੂਮ ਦਾ ਅਤੇ ਦੂਜੇ ਦਾ ਅੱਛਾ ਅੱਛਾ ਅੱਛਾ ਸਾਰਿਆਂ ਦਾ ਇਕੱਠੇ ਹੁੰਦਾ ਹੈ ਹਮ ਹਮ ਠੀਕ ਏ ਹੋਰ ਅਸੀਂ ਏਸੀ ਵਾਲਾ ਹੀ ਲ ਲਵਾਂਗੇ ਕਮਰਾ ਉਹੀ ਬੁੱਕ ਕਰ ਦਿਓ ਹਮ ਹਾਂ ਅਤੇ ਤੁਸੀਂ ਮਿਲ ਜੋਗੇ ਫਿਰ ਸਾਨੂੰ ਪਰਸੋਂ ਜਦੋਂ ਅਸੀ ਆਵਾਂਗੇ ਇੱਥੇ ਅੱਛਾ ਠੀਕ ਹੈ ਪਰ ਜੇ ਹੁਣ ਤੁਹਾਨੂੰ ਕਾਲ ਕੀਤੀ ਨਾ ਜੇ ਤੁਸੀਂ ਮਿਲੋਗੇ ਤਾਂ ਹੀ ਮਿਲੇਗਾ ਜੇ ਕਮਰਾ ਨਹੀਂ ਤਾਂ ਉਂਝ ਜੇ ਕੋਈ ਹੋਰ ਆ ਗਿਆ ਤਾਂ ਫਿਰ ਠੀਕ ਠੀਕ ਏ ਠੀਕ ਏ ਠੀਕ ਏ ਫਿਰ ਨਾਲੇ ਅਸੀਂ ਪੰਚਮੀ ਦੇ ਪੰਚਮੀ ਵੀ ਦੇਖਾਂਗੇ ਦਰਸ਼ਨ ਕਰਾਂਗੇ ਸੰਗਤਾਂ ਆਉਣਗੀਆਂ ਸਾਰਾ ਕੁਛ ਅੱਛਾ ਅੱਛਾ ਚਲੋ ਅਸੀਂ ਵੀ ਆਵਾਂਗੇ ਸੱਚੇ ਪਾਤਸ਼ਾਹ ਦਰਸ਼ਨ ਮੇਲੇ ਕਰਾਂਗੇ ਨਾਲੇ ਕੀਰਤਨ ਬਾਣੀ ਸੁਣਾਂਗੇ ਬਵਾਂਗੇ ਉੱਥੇ ਹਾਂ ਇਸੇ ਕਰਕੇ ਆਉਂਦੇ ਕਿ ਦੋ ਦਿਨ ਲਾਵਾਂਗੇ ਅਤੇ ਦੋ ਦਿਨ 'ਚ ਵਧੀਆ ਦਰਸ਼ਨ ਮੇਲੇ ਹੋਣਗੇ ਹਾਂ ਹੋਰ ਤਾਂ ਹੋਰ ਵੀ ਗੁਰਦੁਆਰਾ ਸਾਹਿਬ ਹੈਗੇ ਨੇ ਇੱਥੇ ਕਿ ਅੱਛਾ ਚਲੋ ਚਲੋ ਉਹਨਾਂ ਨਾਲ ਤਾਂ ਬਾਅਦ 'ਚ ਦੇਖੀ ਜਾਵੇਗੀ ਆ ਕੇ ਫਿਰ ਵੇਖ ਲਾਂਗੇ ਇੱਥੋਂ ਜ਼ਿਆਦਾ ਇੱਥੋਂ ਵਾਲੇ ਇਤਿਹਾਸ ਵੇਖਿਆ ਸੀ ਅਤੇ ਇੱਥੇ ਦਿਲ ਕੀਤਾ ਕਿ ਜਾ ਕੇ ਆਈਏ ਚਲੋ ਵੇਖਦੇ ਹਾਂ ਫਿਰ ਅਸੀਂ ਪਰਸੋਂ ਪਹੁੰਚ ਜਾਵਾਂਗੇ ਇੱਥੇ ਸਾਡੇ ਕਮਰੇ ਦੀ ਬੁਕਿੰਗ ਰੱਖਿਓ ਅਤੇ ਚਲੋ ਫਿਰ ਹਾਂ ਹਾਂ ਠੀਕ ਏ ਠੀਕ ਏ ਚਲੋ ਫਿਰ ਮਿਲਾਂਗੇ ਪਰਸੋਂ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ